ਦੇਖਿਆ ਜਾਵੇ ਤਾਂ ਜਿਹੜਾ ਪੰਜਾਬ ਦਾ ਵਪਾਰਕ ਖੇਤਰ ਹੈ ਉਹ ਪੰਜਾਬ ਵਿੱਚ ਨਵੀਨਤਾ ਵੀ ਲੈ ਕੇ ਆਇਆ ਅਤੇ ਚੰਗੇ ਪੰਜਾਬ ਦੀ ਸਿਰਜਨਾ ਵੀ ਕੀਤੀ ਹੈ ਇਸ ਦਾ ਕੁਛ ਉਦਾਹਰਨ ਮੈਂ ਤੁਹਾਨੂੰ ਦੱਸਦੀ ਹਾਂ ਜਿਵੇਂ ਕਿ ਪਹਿਲਾਂ ਘਰ ਦਾ ਇੱਕ ਮੈਂਬਰ ਬਾਜ਼ਾਰ ਜਾਂਦਾ ਸੀ ਉਹ ਬਾਕੀ ਸਾਰੇ ਘਰ ਦੇ ਮੈਂਬਰਾਂ ਲਈ ਸਮਾਨ ਲੈ ਆਉਂਦਾ ਸੀ ਚਾਹੇ ਉਹ ਕੱਪੜੇ ਲੀੜੇ ਹੋਣ ਚਾਹੇ ਉਹ ਜੁੱਤੇ ਜੋੜੇ ਹੋਣ ਭਾਵੇਂ ਘਰ ਦਾ ਰਾਸ਼ਨ ਹੋਵੇ ਪਰ ਹੁਣ ਜਿਹੜੀ ਇ ਇਸ ਨਵੀਨਤਾ ਨੇ ਓਨਲਾਈਨ ਕੰਮ ਸ਼ੁਰੂ ਕਰਤਾ ਵਪਾਰ ਨੇ ਉਸ ਦੇ ਨਾਲ ਹਰ ਇਨਸਾਨ ਚਾਹੇ ਉਹ ਲੇਡੀਜ਼ ਹੈ ਜੈਂਟਸ ਹੈ ਬੱਚੇ ਹੈ ਉਹ ਘਰ ਬੈਠੇ ਆਪਨੀ ਮਰਜ਼ੀ ਨਾਲ ਆਪਣਾ ਲੋੜੀਂਦਾ ਸਮਾਨ ਮੰਗਵਾ ਸਕਦੇ ਹਨ ਇਹ ਵੀ ਵਪਾਰ ਦੇ ਖੇਤਰ ਨੇ ਬਹੁਤ ਪੰਜਾਬ ਨੂੰ ਅੱਗੇ ਲੈ ਕੇ ਗਿਆ ਜਿਸ ਦੇ ਨਾਲ ਸਾਡਾ ਸਮਾਂ ਵੀ ਬਚਦਾ ਹੈ ਅਤੇ ਸਮਾਂ ਬਚਣ ਦੇ ਨਾਲ ਅਸੀਂ ਉਹੀ ਸਮਾਂ ਕਿਸੇ ਹੋਰ ਕੰਮ ਦੇ ਵਿੱਚ ਲਗਾ ਸਕਦੇ ਹਾਂ ਵਪਾਰਕ ਖੇਤਰ ਦੇ ਵਿੱਚ